ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਮੋਹਾਲੀ ਸਟੇਸ਼ਨ ਤੋਂ ਬੋਲ ਰਹੇ ਹਾਂਜੀ ਭਾਅ ਜੀ ਮੈਂ ਆਪਣਾ ਇੱਧਰ ਘੁੰਮਣ ਜਾਣਾ ਸੀ ਤੁਸੀਂ ਮੈਨੂੰ ਦੱਸ ਸਕਦੇ ਹੋ ਕੀ ਮੋਹਾਲੀ ਤੋਂ ਕਿੱਥੇ ਕਿੱਥੇ ਨੂੰ ਟਰੇਨ ਜਾਂਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਮੈਂ ਆਪਣਾ ਅੰਮ੍ਰਿਤਸਰ ਜਾਣਾ ਹੈ ਜੀ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਆਪਣਾ ਲੌਕਲ ਦਾ ਐਚ ਪੀ ਐਸ ਦਾ ਕੀ ਪਰਾਇਜ਼ ਹੈ ਠੀਕ ਹੈ ਅਤੇ ਆਪਣੀ ਜਿਹੜੀ ਏ ਸੀ ਆਲੀ ਟਰੇਨ ਹੈ ਉਹਦਾ ਕੀ ਹਿਸਾਬ ਕਿਤਾਬ ਹੈ ਅਤੇ ਸਫ਼ਾਈ ਵਗੈਰਾ ਕਿਵੇਂ ਹੋਉਗੀ ਅੱਛਾ ਜੀ ਅੱਛਾ ਜੀ ਅੱਛਾ ਅਤੇ ਉਹਦੇ ਵਿੱਚ ਸਾਨੂੰ ਖਾਣੇ ਨੂੰ ਫੂਡ ਵਗੈਰਾ ਮਿਲੂ ਕਿ ਸਾਨੂੰ ਆਪਣਾ ਲੈ ਕੇ ਆਉਣਾ ਪੈਣਾ ਅੱਛਾ ਜੀ ਅਤੇ ਟੈਮ ਕਿੰਨੇ ਵਜੇ ਹੈ ਭਾਅ ਜੀ ਅੱਛਾ ਜੀ ਚਲੋ ਕੋਈ ਗੱਲ ਨੀ ਭਾਅ ਜੀ ਠੀਕ ਹੈ ਜੀ ਥੈਂਕ ਯੂ ਜੀ